ਸਾਡੇ ਖੇਤਰ ਵਿੱਚ ਕਈ ਪ੍ਰਕਾਰ ਦੀਆਂ ਖੇਡਾਂ ਹਨ ਜਿਸ ਨੂੰ ਕਿ ਕਈ ਲੋਕਾਂ ਦੁਆਰਾ ਖੇਡਿਆ ਜਾਂਦਾ ਹੈ ਘਰ ਕਈ ਲੋਕ ਤਾਂ ਘਰ ਵਿੱਚ ਵੀ ਖੇਡਦੇ ਹਨ ਕਈ ਗੇਮਾਂ ਇਹੋ ਜਿਹੀਆਂ ਵੀ ਹੁੰਦੀਆਂ ਹਨ ਜਿਹੜੀਆਂ ਘਰ ਦੇ ਅੰਦਰ ਵੀ ਖੇਡੀਆਂ ਜਾ ਸਕਦੀਆਂ ਹਨ ਸਾਡੇ ਖੇਤਰ ਵਿੱਚ ਇੱਕ ਕ੍ਰਿਕਟ ਦਾ ਕਾਫੀ ਬੋਲਬਾਲਾ ਹੈ ਸਾਡੇ ਇਲਾਕੇ ਦੇ ਵਿੱਚ ਇੱਕ ਕ੍ਰਿਕਟ ਅਕੈਡਮੀ ਵੀ ਹੈ ਜਿਸ ਵਿੱਚ ਕਾਫੀ ਸਕੂਲੀ ਬੱਚਿਆਂ ਨੇ ਦਾਖਲਾ ਲਿਆ ਹੋਇਆ ਹੈ ਅਤੇ ਬਹੁਤ ਵਧੀਆ ਗੇਮ ਖੇਡਦੇ ਆ ਸਾਡੇ ਇਲਾਕੇ ਦੇ ਵਿੱਚ ਇੱਕ ਬਾਸਕਿਟਬਾਲ ਦਾ ਗਰਾਊਂਡ ਵੀ ਹੈ ਜਿਸ ਵਿੱਚ ਕਈ ਬੱਚੇ ਖੇਡਦੇ ਹਨ ਅਤੇ ਸਾਡੇ ਇਲਾਕੇ ਦੇ ਵਿੱਚ ਇੱਕ ਪਾਰਕ ਵੀ ਹੈ ਕਈ ਔਰਤਾਂ ਵੀ ਉੱਥੇ ਆਉਂਦੀਆਂ ਹਨ ਅਤੇ ਬੈਡਮਿੰਟਨ ਵੀ ਖੇਡਦੀਆਂ ਹਨ ਕਈ ਸੈਰ ਕਰਦੀਆਂ ਹਨ ਕਈ ਬੱਚੇ ਗੇਂਦ ਗੇਂਦ ਕੇਚਿੰਗ ਵੀ ਖੇਡਦੇ ਆ ਕਈ ਪ੍ਰਕਾਰ ਦੇ ਉੱਥੇ ਝੂਲੇ ਲੱਗੇ ਹੋਏ ਹਨ ਬੱਚੇ ਉਹਨਾਂ 'ਤੇ ਵੀ ਖੇਡਦੇ ਆ ਇਸੇ ਤਰ੍ਹਾਂ ਸਾਡੇ ਖੇਤਰ ਵਿੱਚ ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਂਦੀਆਂ